ਪੰਜਾਬ ਰਾਜ ਵਿੱਚ ਖੇਤੀਬਾੜੀ ਬਹੁਤ ਹੀ ਵਧੀਆ ਢੰਗ ਨਾਲ਼ ਕੀਤੀ ਜਾਂਦੀ ਹੈ ਅਤੇ ਇੱਥੋਂ ਦੇ ਲੋਕ ਜਿਹੜੇ ਆ ਜ਼ਿਆਦਾਤਰ ਖੇਤੀਬਾੜੀ ਨਾਲ਼ ਜੁੜੇ ਹੋਏ ਹਨ ਅਤੇ ਇੱਥੇ ਦੇ ਜਿਹੜੇ ਲੋਕ ਹੈਗੇ ਆ ਉਹ ਆਪਣੇ ਘਰਾਂ ਵਿੱਚ ਜ਼ਿਆਦਾਤਰ ਜਿਹੜੇ ਮਤਲਬ ਕਿ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਵੀ ਖੇਤੀ ਕਰਦੇ ਆ ਕਿ ਉਹਨਾਂ ਦਾ ਆਪਣੇ ਖਾਣ ਯੋਗ ਖਾਣ ਵਾਸਤੇ ਉਹ ਆਪਣੇ ਘਰਾਂ ਵਿੱਚ ਸਬਜ਼ੀਆਂ ਲਗਾ ਲੈਂਦੇ ਆ ਪਰ ਜਿਹੜੇ ਸ਼ਹਿਰਾਂ ਦੇ ਲੋਕਾਂ ਵਾਸਤੇ ਉਹ ਜਿਹੜੇ ਕਈ ਲੋਕ ਆ ਉਹ ਵਧੀਆ ਤਰ੍ਹਾਂ ਖੇਤੀ ਕਰਕੇ ਸਬਜ਼ੀਆਂ ਵਗੈਰਾ ਨੂੰ ਖਾਦ ਵਗੈਰਾ ਪਾ ਕੇ ਉਹਨਾਂ ਦੇ ਲਈ ਸਬਜ਼ੀ ਵਧੀਆ ਤਰੀਕੇ ਨਾਲ਼ ਤਿਆਰ ਕਰਕੇ ਫਿਰ ਆਪਣੇ ਮੰਡੀਆਂ ਵਿੱਚ ਜਾ ਕੇ ਵੇਚਦੇ ਆ ਅਤੇ ਜਿਹਦੇ ਕਰਕੇ ਜਿਹੜੇ ਆ ਸ਼ਹਿਰਾਂ ਦੇ ਲੋਕਾਂ ਨੂੰ ਵੀ ਬਹੁਤ ਵਧੀਆ ਅਤੇ ਫਰੈਸ਼ ਸਬਜ਼ੀ ਜਿਹੜੀ ਆ ਉਹ ਮਿਲ ਜਾਂਦੀ ਆ ਅਤੇ ਜਿਵੇਂ ਕਿ ਆਪਾਂ ਵੀ ਆਪਣੇ ਘਰ ਵਿੱਚ ਸਬਜ਼ੀ ਲਗਾਈ ਆ ਆਪਣੇ ਖਾਣ ਲਈ ਲਗਾਈ ਆ ਅਤੇ ਆਪਾਂ ਹਰ ਰੋਜ਼ ਜਿਵੇਂ ਧਨੀਆ ਹੋ ਗਿਆ ਮੇਥੀ ਹੋ ਗਈ ਮੂਲੀਆਂ ਹੋ ਗਈਆਂ ਸਾਗ ਵਗੈਰਾ ਆਪਣੇ ਘਰ ਵਿੱਚ ਲਗਾਇਆ ਹੈ ਅਤੇ ਜਿਸ ਤਰ੍ਹਾਂ ਕਿ ਆਪਾਂ ਜਦੋਂ ਵੀ ਸਾਨੂੰ ਜ਼ਰੂਰਤ ਹੁੰਦੀ ਆ ਆਪਾਂ ਤੋੜ ਕੇ ਜਾਂ ਫਿਰ ਉਹਨੂੰ ਯੂਜ ਕਰ ਲੈਂਦੇ ਹਾਂ ਅਤੇ ਜਿਹੜੇ ਆਪਾਂ ਕਣਕ ਵਗੈਰਾ ਉਹ ਆਪਾਂ ਆਪਣੇ ਲਾਗੇ ਜਿਹੜੇ ਖੇ ਕਿਸਾਨ ਆ ਆਪਾਂ ਉਹਨਾਂ ਤੋਂ ਲੈ ਲੈਂਦੇ ਹਾਂ ਜਿੱਦਾਂ ਕਿ ਸਾਨੂੰ ਮਤਲਬ ਕਿ ਪੰਜਾਬ ਵਿੱਚ ਰਹਿ ਕੇ ਬਹੁਤ ਵਧੀਆ ਸਬਜ਼ੀ ਫਰੈੱਸ਼ ਮਿਲ ਜਾਂਦੀ ਆ